ਮੈਂ ਫੇਸਬੁੱਕ ਟਵਿੱਟਰ ਇੰਸਟਾਗਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦਾ ਹਾਂ ਮੈਂ ਇਸ ਵਿੱਚ ਚਲੰਤ ਮੁੱਦੇ ਜਿਵੇਂ ਕਿ ਰਾਜਨੀਤਿਕ ਸੋਸ਼ਲ ਮੁੱਦੇ ਅਤੇ ਮਨੋਰੰਜਨ ਦੀਆਂ ਵੀਡੀਓਜ ਦੇਖਣਾ ਪਸੰਦ ਕਰਦਾ ਹਾਂ ਇਸ ਵਿੱਚ ਮੈਂ ਆਪਣੀਆਂ ਹੀ ਕੁਝ ਫੋਟੋਆਂ ਪੋਸਟ ਕਰਦਾ ਹਾਂ ਇਸ ਵਿੱਚ ਮੈਂ ਤਕਰੀਬਨ ਇੱਕ ਤੋਂ ਡੇਢ ਘੰਟਾ ਬਿਤਾਉਂਦਾ ਹਾਂ ਇਸ ਬਾਰੇ ਮੈਨੂੰ ਜੋ ਪਸੰਦ ਹੈ ਉਹ ਹੈ ਇਸ ਵਿੱਚ ਆਉਣ ਵਾਲੀਆਂ ਵੀਡੀਓਜ ਜਿਨ੍ਹਾਂ ਵਿੱਚ ਮਨੋਰੰਜਨ ਬਹੁਤ ਹੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਤੁਹਾਨੂੰ ਆਪਣੇ ਕੋਲੋਂ ਅਲੱਗ ਨਹੀਂ ਹੋਣ ਦਿੰਦਾ ਨਾ ਪਸੰਦ ਕਰਨ ਵਿੱਚ ਜਾਂ ਇਸ ਵਿੱਚ ਕੁਝ ਚੀਜ਼ਾਂ ਹਨ ਜਿਵੇਂ ਕਿ ਇਸ ਵਿੱਚ ਆਉਣ ਵਾਲੀਆਂ ਜੋ ਵੀ ਚੀਜ਼ਾਂ ਹੁੰਦੀਆਂ ਹਨ ਉਹ ਉਮਰ ਦੀ ਕੋਈ ਹੱਦ ਨਹੀਂ ਦੇਖਦੀਆਂ ਬੱਚਿਆਂ ਨੂੰ ਵੀ ਉਹੀ ਸਭ ਕੁਝ ਮਿਲਦਾ ਹੈ ਜੋ ਵੱਡਿਆਂ ਨੂੰ ਮਿਲਦਾ ਹੈ ਤਾਂ ਇਸ ਨਾਲ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਇਸਦਾ ਫੰਕਸ਼ਨ ਕੁਝ ਇਜ ਇਸ ਤਰ੍ਹਾਂ ਬਣਿਆ ਹੈ ਕਿ ਇਹ ਸਾਨੂੰ ਆਪਣੇ ਨਾਲ ਜਕੜ ਕੇ ਰੱਖ ਲੈਂਦਾ ਹੈ ਅਤੇ ਸਾਨੂੰ ਆਦਤ ਪਾ ਦਿੰਦਾ ਹੈ